ਅੱਜ ਕੱਲ੍ਹ ਦੇ ਲੋਕ ਜੋ ਡਾਂਸ ਸਿੱਖਣ ਲਈ ਕਈ ਤਰੀਕਿਆਂ ਦੀ ਵਰਤੋਂ ਕਰਦੇ ਨੇ ਜਿਵੇਂ ਓਨਲਾਈਨ ਕੋਰਸਾਂ ਦੁਆਰਾ ਹੈਂ ਇੰਟਰਨੈਟ ਦੀਆਂ ਵੈਬਸਾਈਟਾਂ 'ਤੇ ਐਪਾਂ ਜਿਵੇਂ ਕਿ ਯੂਟੀਊਬ ਵਗੈਰਾ ਹੋ ਗਈਆਂ ਅਤੇ ਉਸ ਤੋਂ ਵੀ ਸਿੱਖਣ ਦੀ ਕੋਸ਼ਿਸ਼ ਕਰਦੇ ਨੇ ਸਥਾਨਕ ਸਟੂਡੀਓ ਜਾਂ ਬਹੁਤ ਸਾਰੇ ਲੋਕ ਆਪਣੀ ਜਗ੍ਹਾ 'ਤੇ ਡਾਂਸ ਸਟੂਡੀਓ ਕਲਾਸਾਂ ਜਾਂ ਜਾ ਕੇ ਡਾਂਸ ਨੂੰ ਸਿੱਖਦੇ ਨੇਗੇ ਜੋ ਕਿ ਪ੍ਰੋਫੈਸਨਲ ਤਰੀਕੇ ਦੇ ਨਾਲ ਪ੍ਰੋਫੈਸਨਲ ਅਧਿਆਪਕਾਂ ਦੁਆਰਾ ਸਿੱਖਣ ਦਾ ਮੌਕਾ ਮਿਲਦਾ ਹੈ ਜਿਵੇਂ ਸ਼ੋਸਲ ਮੀਡੀਆ 'ਤੇ ਵੀ ਜਿਵੇਂ ਕਿ ਟਿੱਕਟੋਕ ਵਗੈਰਾ ਐਪਾਂ ਨੇਗੀਆਂ ਅਤੇ ਇੰਸਟਾਗਰਾਮ ਹੋ ਗਿਆ ਯੂਟੀਊਬ ਹੋ ਗਏ ਇਸ ਤਰ੍ਹਾਂ ਦੇ ਕਈ ਪਲੇਟਫਾਰਮ ਨੇਗੇ ਜਿੱਥੇ ਜਿੱਥੋਂ ਲੋਕ ਡਾਂਸ ਸਿੱਖਣਾ ਪਸੰਦ ਕਰਦੇ ਨੇਗੇ ਸਮਾਰਟ ਫੋਨਾਂ ਦੇ ਵਿੱਚ ਬਹੁਤ ਸਾਰੀਆਂ ਐਪਸ ਨੇਗੀਆਂ ਜੋ ਜੋ ਡਾਂਸ ਸਿੱਖਣ ਦੇ ਲਈ ਜੋ ਵਿਦਿਆਰਥੀਆਂ ਨੂੰ ਸਿਖਾਉਣ ਦੇ ਤਰੀਕੇ ਟਿਪਸ ਸਟਾਈਲਾਂ 'ਤੇ ਮਤਲਬ ਧਿਆਨ ਕੇਂਦਰਿਤ ਕਰਵਾਉਂਦੇ ਨੇ ਲੋਕ ਅੱਜ ਕੱਲ੍ਹ ਡਾਂਸ ਇਸ ਕਰਕੇ ਵੀ ਸਿੱਖਦੇ ਨੇਗੇ ਕਿਉਂ ਮਨੋਰੰਜਨ ਦੇ ਲਈ ਵੀ ਡਾਂਸ ਸਿੱਖਦੇ ਨੇਗੇ ਜਿਹੜਾ ਨਾਚ ਹੁੰਦਾ ਗਾ ਅਤੇ ਉਹ ਉਹ ਲੋਕ ਆਪਣੇ ਵਿਆਹਾਂ ਸ਼ਾਦੀਆਂ 'ਤੇ ਅਤੇ ਹਰ ਖੁਸ਼ੀ ਦੇ ਮੌਕਿਆਂ 'ਤੇ ਲੋਕ ਡਾਂਸ ਕਰਦੇ ਨੇਗੇ ਭੰਗੜਾ ਪਾਉਂਦੇ ਨੇਗੇ ਅਤੇ ਇਹ ਸਿਹਤ ਲਈ ਵੀ ਬਹੁਤ ਜ਼ਿਆਦਾ ਮਤਲਬ ਲਾਭਦਾਇਕ ਆ ਡਾਂਸ ਸਰੀਰਕ ਫਿਟਨੈਸ ਨੂੰ ਜਿਹੜਾ ਬਿਹਤਰ ਬਣਾਉਂਦਾ ਗਾ ਤੇ ਅਤੇ ਸਟੈਪ ਸਟਰੈਸ ਨੂੰ ਵੀ ਘਟਾਉਂਦਾ ਗਾ ਇਹ ਅਤੇ ਸਮਾਜਿਕ ਪਹਿਲੂਆਂ ਦੇ ਸਮਾਜਿਕ ਪਹਿਲੂ ਵੀ ਇੱਕ ਇਸਦਾ ਹੈ ਡਾਂਸ ਸਿੱਖਣ ਦੇ ਵਿੱਚ ਜਿਹੜਾ ਮਦਦ ਕਰਦਾ ਹੈ ਦੋਸਤ ਬਣਾਉਂਦੇ ਨੇ ਨਵੇਂ ਨਵੇਂ ਲੋਕ ਦੋਸਤ ਬਣਾ ਲੈਂਦੇ ਨੇ ਹੈ ਨਾ ਅਤੇ ਸਰੀਰ ਦੀ ਕਸਰਤ ਹੁੰਦੀ ਹੈਗੀ ਅਤੇ ਆਪਣੀ ਜਿਹੜੀ ਸਮਰੱਥਾ ਹੁੰਦੀ ਉਹਦਾ ਵਿਕਾਸ ਹੁੰਦਾ ਗਾ ਅਤੇ ਬਹੁਤ ਸਾਦਾ ਬਹੁਤ ਸਾਰੇ ਇਸਦੇ ਜਿਹੜੇ ਨੇ ਲਾਭ ਨੇਗੇ ਜਿਹੜਾ ਕਿ ਡਾਂਸ ਹੈਗਾ ਅਤੇ ਇਸ ਕਰਕੇ ਲੋਕ ਇਸ ਡਾਂਸ ਨੂੰ ਡਾਂਸ ਸਿੱਖਦੇ ਨੇਗੇ ਅਤੇ